ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਭਾਅ ਜੀ ਚਲੋ ਕੋਈ ਚੱਕਰ ਨਹੀਂ ਤੁਹਾਨੂੰ ਮੈਂ ਦੱਸ ਦਿੰਦਾ ਏ ਆ ਹਾਂਜੀ ਅਤੇ ਜਿਹੜਾ ਖਾਸ ਨਵਾਂ ਸ਼ਹਿਰ ਦੇ ਵਿੱਚ ਆਪਣਾ ਜਿੱਧਰ ਤੁਸੀਂ ਦੇਖਿਆ ਹੋਣਾ ਬੱਸ ਸਟੈਂਡ ਹੈਗਾ ਜੀ ਹਾਂਜੀ ਜਿਹੜੀ ਉੱਧਰ ਮੋਨੂੰ ਹੋਣਾ ਦੀਆਂ ਰੇਹੜੀਆਂ ਲੱਗਦੀਆਂ ਆ ਹਾਂਜੀ ਉਹ ਸਭ ਨਾਲੋਂ ਵੈਸਟ ਹੈ ਜੀ ਅਤੇ ਉਹ ਆਪਣਾ ਜਾਣੀ ਕਿ ਪੈਦਾ ਕਰ ਉਹ ਕਰਦੇ ਆ ਉਹ ਉਗਾਉਂਦੇ ਆ ਹਾਂਜੀ ਇੱਕ ਉੱਧਰ ਵੀ ਸਹੀ ਆ ਭਾਅ ਜੀ ਭਾਅ ਜੀ ਸਭ ਕੁਛ ਮਿਲੇਗਾ ਭਾਅ ਜੀ ਨਾਲੇ ਵਧੀਆ ਐਨ ਕੋਈ ਦਾਗੀ ਦੁੱਗੀ ਨਹੀਂ ਮਿਲਦਾ ਹਾਂਜੀ ਅਤੇ ਜਾਂ ਫਿਰ ਜਿਹੜਾ ਆਪਣਾ ਹੋਸਪੀਟਲ ਵੱਲ ਵੀ ਤੁਸੀਂ ਜਾ ਸਕਦੇ ਹਾਂ ਉੱਥੇ ਵੀ ਜਾਣੀ ਕੀ ਵਧੀਆ ਰੇਹੜੀਆਂ ਲੱਗੀ ਵੀਆਂ ਹਾਂਜੀ ਹਾਂਜੀ ਜਿੱਧਰ ਆਪਣਾ ਰੇਲਵੇ ਸਟੇਸ਼ਨ ਆ ਅਤੇ ਉਹ ਤੋਂ ਥੋੜ੍ਹਾ ਜਿਹਾ ਇੱਧਰ ਨੂੰ ਆ ਕੇ ਉੱਥੇ ਸ਼ੋਪ ਵੀ ਹੈ ਜੀ ਆਪਾਂ ਉੱਥੋਂ ਵੀ ਲੈ ਸਕਦੇ ਹਾਂ ਸਮਾਨ ਰੇਟ ਭਾਅ ਜੀ ਸਹੀ ਉ ਉਨਾਂ ਹੀ ਰੇਟ ਆ ਜਿੰਨੇ ਕਿ ਆਮ ਆਪਾਂ ਰੇਹੜੀ ਵਾਲੇ ਦਿੰਦੇ ਹੀ ਆ ਹਾਂਜੀ ਹਾਂਜੀ ਜਾਣੀ ਕਿ ਜ਼ਿਆਦਾ ਫਰਕ ਨਹੀਂ ਹੈਗਾ ਨਹੀਂ ਨਹੀਂ ਭਾਅ ਜੀ ਨਹੀਂ ਨਹੀਂ ਭਾਅ ਜੀ ਹਮ ਹਾਂਜੀ ਹਾਂਜੀ ਬਿਲਕੁਲ ਭਾਅ ਜੀ ਭਾਅ ਜੀ ਉੱਥੇ ਗਰੰਟੀ ਨਾਲ ਚੀਜ਼ ਦਿੰਦੇ ਜਾਣੀ ਕਿ ਤੁਹਾਨੂੰ ਪਤਾ ਹੀ ਹੁਣ ਸਬਜ਼ੀਆਂ ਕਿੰਨਾਂ ਕੁ ਟਾਈਮ ਕੱਢਦੀਆਂ ਆ ਪਰ ਫਿਰ ਵੀ ਉਹਦੀ ਹੱਦ ਤੋਂ ਜ਼ਿਆਦਾ ਟਾਈਮ ਕੱਢ ਦਿੰਦੀਆਂ ਅਤੇ ਨਾਲੇ ਰੇਟ ਵੀ ਉਹਨਾਂ ਦਾ ਠੀਕ ਆ ਅਤੇ ਨਾਲੇ ਹਾਂਜੀ ਉਹ ਨਹੀਂ ਹੈ ਜਾਣੀ ਕਿ ਟੀਕੇ ਟੂਕੇ ਵਾਲੀਆਂ ਨਹੀਂ ਹੈਗੀਆਂ ਅਤੇ ਸਭ ਨਾਲੋਂ ਵੱਡੀ ਗੱਲ ਇਹ ਹੈ ਜੀ ਉਹਨਾਂ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਭਾਅ ਜੀ ਹਾਂ ਹਾਂਜੀ ਓਕੇ ਹਾਂਜੀ ਹਾਂਜੀ ਇਟ ਇਸ ਓਕੇ ਭਾਅ ਜੀ ਓ